ਸਤਿ ਸ਼੍ਰੀ ਅਕਾਲ ਮੇਰਾ ਨਾਮ ਸ਼ਬਾ ਨਸ਼ਾਦ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਕੱਲ੍ਹ ਮੈਂ ਆਪਣਾ ਪਿਜ਼ਾ ਔਡਰ ਕੀਤਾ ਸੀ ਅਤੇ ਉਹਦੀ ਪੇਮੈਂਟ ਕੱਟਣ ਦਾ ਮੈਸੇਜ ਮੇਰੇ ਕੋਲ ਆ ਗਿਆ ਸੀ ਪਰ ਦੁਕਾਨਦਾਰ ਵੱਲੋਂ ਮੈਨੂੰ ਮੈਸੇਜ ਆਇਆ ਕਿ ਤੁਹਾਡੇ ਔਰਡਰ ਦੀ ਪੇਮੈਂਟ ਅਜੇ ਤੱਕ ਨਹੀਂ ਪਹੁੰਚੀ ਮੈਂ ਬਹੁਤ ਪਰੇਸ਼ਾਨ ਹਾਂ ਮੈਂ ਪਹਿਲਾਂ ਵੀ ਔਰਡਰ ਕਰਦੀ ਹਾਂ ਪਰ ਅਜੇ ਤੱਕ ਇਸ ਤਰ੍ਹਾਂ ਕੋਈ ਪਰੇਸ਼ਾਨੀ ਨਹੀਂ ਹੋਈ ਅਤੇ ਇਹ ਮੇਰੇ ਨਾਲ ਪਹਿਲੀ ਵਾਰ ਹੋਇਆ ਹੈ ਪਹਿਲਾਂ ਇਸ ਪ੍ਰੋਬਲਮ ਨੂੰ ਹੱਲ ਕੀਤਾ ਜਾਵੇ ਕਿਉਂਕਿ ਅਜੇ ਤੱਕ ਦੁਕਾਨਦਾਰ ਨੂੰ ਪੇਮੈਂਟ ਪਹੁੰਚੀ ਨਹੀਂ ਮੈਂ ਉਹਨਾਂ ਦੀ ਰੈਗੂਲਰ ਕਸਟਮਰ ਹਾਂ ਮੈਨੂੰ ਡਰ ਹੈ ਕਿ ਕਿਤੇ ਪੇਮੈਂਟ ਨਾ ਮਿਲਣ ਕਾਰਨ ਉਹ ਮੇਰੇ ਦੋਸਤਾਂ ਸਾਹਮਣੇ ਮੇਰੀ ਬੇਇੱਜ਼ਤੀ ਨਾ ਕਰ ਦੇਣ ਮੈਂ ਤੁਹਾਡੀ ਬਹੁਤ ਬਹੁਤ ਧੰਨਵਾਦੀ ਹੋਵਾਂਗੀ ਅਤੇ ਤੁਸੀਂ ਇਸ ਪ੍ਰੋਬਲਮ ਦਾ ਜਲਦੀ ਤੋਂ ਜਲਦੀ ਹੱਲ ਕਰ ਦਿਉ